ਮੈਨੂੰ ਚਿੱਤਰਕਾਰੀ ਕਰਨ ਦਾ ਬਹੁਤ ਸ਼ੌਂਕ ਹੈ ਮੈਂ ਸਕੂਲ ਦੇ ਸਮੇਂ ਤੋਂ ਹੀ ਚਿੱਤਰਕਾਰੀ ਕਰਦੀ ਆ ਰਹੀ ਹਾਂ ਆਪਣੀ ਇਸ ਕਲਾ ਨੂੰ ਨਿਖਾਰਨ ਦੇ ਲਈ ਆਪਣੇ ਨਜ਼ਦੀਕੀ ਬਣੇ ਕਲਾ ਕੇਂਦਰ ਵਿੱਚ ਅਭਿਆਸ ਕਰਨ ਜਾਂਦੀ ਹਾਂ ਉੱਥੇ ਮੈਂ ਬਹੁਤ ਤਰ੍ਹਾਂ ਦੀਆਂ ਤਸਵੀਰਾਂ ਜਿਵੇਂ ਆਮ ਜ਼ਿੰਦਗੀ ਦੇ ਨਾਲ਼ ਤਾਲੁਕਾਤ ਰੱਖਦੀਆਂ ਤਸਵੀਰਾਂ ਬਣਾਉਣੀ ਸਿੱਖੀਆਂ ਹਨ ਉੱਥੇ ਆਪਣੀ ਕਲਾ ਨੂੰ ਨਿਖਾਰਨ ਦਾ ਮੌਕਾ ਮਿਲਿਆ ਇਸ ਦਾ ਅਨੁਭਵ ਮੇਰੇ ਜੀਵਨ ਵਿੱਚ ਬਹੁਤ ਵਧੀਆ ਰਿਹਾ